ਹਾਂਜੀ ਮੈਮ ਕਿਹੜੀ ਕਿਹੜੀ ਬੁੱਕਸ ਚਾਹੀਦੀਆਂ ਹੈ ਜੀ ਅੱਛਾ ਜੀ ਹਾਂ ਮਿਲ ਜੇਗੀ ਇਹ ਹੀ ਇਹ ਵੀ ਚੈੱਕ ਕਰਾ ਲੂੰਗਾ ਹਾਂਜੀ ਇਹ ਵੀ ਪਈ ਹੋਏਗੀ

ਇਸ ਤੋਂ ਇਲਾਵਾ ਕੁਛ ਪੈੱਨ ਵਗੈਰਾ ਕੁਛ ਹੋਰ

ਹੋਮ ਡਿਲੇਵਰੀ ਕਿੱਥੇ ਭੇਜਣੀ ਕਿੱਥੇ ਮੈਮ ਫੂਲ ਚੱਕਰ ਮੁਹੱਲਾ ਕਿਹੜੀ ਸਾਈਡ ਪੈਂਦਾ ਇਹ ਅੱਛਾ ਬੇਲਾ ਚੌਂਕ ਦੇ ਕੋਲ ਹਾਂਜੀ ਹਾਂਜੀ ਕੋਈ ਗੱਲ ਨਹੀਂ ਪਹੁੰਚਾ ਦਾਂਗੇ ਹਾਂਜੀ ਪੈਮੇਂਟ ਹੋ ਜੇਗੀ ਔਨਲਾਈਨ ਉਹ ਮੈਂ ਤੁਹਾਨੂੰ ਸਕੈਨਰ ਭੇਜ ਦੂੰਗਾ ਤੁਸੀਂ ਉਹਦੇ ਉੱਪਰ ਗੂਗਲ ਪੇ ਕਰਾ ਦਿਓ ਚਾਹੇ ਨੰਬਰ ਦੇ ਦਿਉ ਨੰਬਰ ਭੇਜ ਦੂੰਗਾ ਨੰਬਰ ਪਰ ਗੂਗਲ ਪੇ ਕਰਾ ਦਿਓ ਜਿੱਦਾਂ ਮਰਜ਼ੀ ਕਰ ਲਿਓ ਚਾਹੇ ਤੁਸੀਂ ਜੇ ਘਰ ਦੇਣੇ ਤਾਂ ਕੈਸ਼ ਆਨ ਡਿਲੇਵਰੀ ਵੀ ਹੋ ਜੇਗਾ ਹਾਂਜੀ ਠੀਕ ਹੈ ਜੀ